ਸਤਿ ਸ਼੍ਰੀ ਅਕਾਲ ਸਰ ਮੈਂ ਕਾਰਤਿਕ ਪਠਾਨਕੋਟ ਦਾ ਨਿਵਾਸੀ ਅੱਜ ਤੁਹਾਨੂੰ ਧਰਮ ਧਰਮ ਲੋਕਾਂ ਨੂੰ ਕਿਵੇਂ ਇਕੱਠੇ ਕਰਦਾ ਹੈ ਧਰਮ ਸਾਨੂੰ ਆਪਸ ਵਿੱਚ ਰਹਿਣ ਦੀ ਪ੍ਰੇਰਨਾ ਦਿੰਦਾ ਹੈ ਕਿਉਂਕਿ ਧਰਮ ਹੀ ਹੈ ਜਿਸ ਨਾਲ ਸਾਡੇ ਆਪਸੀ ਸਬੰਧ ਬਣੇ ਰਹਿੰਦੇ ਹਨ ਜਿਸ ਨਾਲ ਸਾਨੂੰ ਆਪਣੀ ਆਪਣੀ ਜਾਤ ਆਪਣੇ ਆਪਣਾ ਆਪਣੇ ਆਪ ਦੀ ਪਹਿਚਾਣ ਹੁੰਦੀ ਹੈ ਕਿ ਅਸੀਂ ਹਿੰਦੂ ਹਾਂ ਔਰ ਸਨਾਤਨੀ ਹਾਂ ਜਿਸ ਨਾਲ ਸਾਨੂੰ ਕਾਫ਼ੀ ਸਿੱਖਿਆ ਵੀ ਮਿਲਦੀ ਹੈ ਸਾਨੂੰ ਆਪਣਾ ਧਰਮ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਧਰ ਇੱਕ ਆਪਣਾ ਇਕੱਠੇ ਧਰਮ ਭਾਈਚਾਰਾ ਸਾਨੂੰ ਧਰਮ ਆ ਸਾਡੇ ਭਾਈਚਾਰੇ ਨੂੰ ਇਕੱਠੇ ਰੱਖਦਾ ਹੈ ਇੱਕ ਹੀ ਧਰਮ ਹੋਣ ਨਾਲ ਸਾਡੇ ਕਈ ਭਰਾਵਾਂ ਨੂੰ ਆਪਸ ਵਿੱਚ ਪਿਆਰ ਕਾਫ਼ੀ ਜ਼ਿਆਦਾ ਵਧ ਜਾਂਦਾ ਹੈ ਜਿਸ ਨਾਲ ਉਹ ਇੱਕ ਦੂਜੇ ਦੀ ਬੁਰਾਈ ਨਹੀਂ ਕਰਦੇ ਲੜਾਈ ਝਗੜਾ ਕਾਫ਼ੀ ਘੱਟ ਹੋ ਜਾਂਦਾ ਹੈ ਜਿਸ ਨਾਲ ਸਾਡੇ ਭਾਰਤ ਦੀ ਕਾਫ਼ੀ ਖੁਸ਼ਹਾਲੀ ਵੱਧਦੀ ਹੈ ਅਤੇ ਸਾਨੂੰ ਆਪਸ ਆਪਸੀ ਭਾਈਚਾਰਾ ਕਾਫ਼ੀ ਕੰਮ ਕੰਮ ਵੀ ਆਉਂਦਾ ਹੈ ਅਤੇ ਸਾਨੂੰ ਆਪਣਾ ਧਰਮ ਕਦੇ ਨਹੀਂ ਭੁੱਲਣਾ ਚਾਹੀਦਾ ਔਰ ਆਪਣੇ ਧਰਮ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਪਿਆਰ ਕਰਨਾ ਚਾਹੀਦਾ ਹੈ ਕਿਉਂਕਿ ਆਪਣੇ ਧਰਮ ਨਾਲ ਹੀ ਆਪਣਾ ਜੀਵਨ ਹੁੰਦਾ ਹੈ ਔਰ ਆਪਣੇ ਧਰਮ ਵਿੱਚ ਹੀ ਆਪਣੀ ਖੁਸ਼ਹਾਲੀ ਕਿਉਂਕਿ ਧਰਮ ਹੀ ਆ ਜੋ ਸਾਨੂੰ ਆਪਣੇ ਆਪਣੇ ਆਪਣੇ ਵੰਸ਼ ਨੂੰ ਅੱਗੇ ਵਧਣ ਦੀ ਆਗਿਆ ਅੱਗੇ ਵਧਣ ਦੀ ਸ਼ਿਕਸ਼ਾ ਔਰ ਵੀ ਕਈ ਕੁਝ ਚੀਜ਼ਾਂ ਦਿੰਦਾ ਹੈ ਕਿਉਂਕਿ ਧਰਮ ਕਾਫ਼ੀ ਸਾਡੇ ਲਈ ਕਾਫ਼ੀ ਕਾਫ਼ੀ ਜ਼ਿਆਦਾ ਮਾਇਨੇ ਰੱਖਦਾ ਹੈ ਧੰਨਵਾਦ